ਹਾਂਜੀ ਸਾਡੇ ਖੇਤਰ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਬਦਲੀ ਹੈ ਅਤੇ ਹੁਣ ਔਰਤਾਂ ਬਹੁਤ ਪੜ੍ਹੀਆਂ ਲਿਖੀਆਂ ਹਨ ਅਤੇ ਪੜ੍ਹਾਈ ਵਿੱਚ ਵੀ ਬਹੁਤ ਅੱਗੇ ਹਨ ਅਤੇ ਨੌਕਰੀਆਂ ਵਿੱਚ ਵੀ ਬਹੁਤ ਅੱਗੇ ਹਨ ਜਿਵੇਂ ਬੈਂਕਾਂ ਦੀਆਂ ਨੌਕਰੀਆਂ ਹਨ ਉੱਥੇ ਵੀ ਜ਼ਿਆਦਾਤਰ ਔਰਤਾਂ ਹੀ ਕੰਮ ਕਰਦੀਆਂ ਹਨ ਅਤੇ ਪੁਲਸ ਮਹਿਕਮਾਂ ਵਿੱਚ ਵੀ ਵੱਡੇ ਅਹੁਦਿਆਂ 'ਤੇ ਔਰਤਾਂ ਹੀ ਜ਼ਿਆਦਾ ਬੈਠੀਆਂ ਹਨ ਅਤੇ ਜਿੱਥੇ ਵੀ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਅਤੇ ਪੜ੍ਹਾਉਣ ਜਾਂਦੇ ਹਨ ਅਤੇ ਉੱਥੇ ਜ਼ਿਆਦਾ ਹੀ ਔਰਤਾਂ ਦਾ ਹੀ ਜ਼ਿਆਦਾ ਜ਼ਿਆਦਾ ਕੰਮ ਹੈ ਅਤੇ ਉੱਥੇ ਪੜ੍ਹਨ ਵੀ ਜ਼ਿਆਦਾ ਔਰਤਾਂ ਹੀ ਆਉਂਦੀਆਂ ਹਨ ਅਤੇ ਪੜ੍ਹਾਉਣ ਲਈ ਵੀ ਔਰਤਾਂ ਹੀ ਆਉਂਦੀਆਂ ਹਨ ਅਤੇ ਜਿਵੇਂ ਘੱਟ ਪੜ੍ਹੀਆਂ ਲਿਖੀਆਂ ਔਰਤਾਂ ਨੇ ਉਹ ਅੱਜ ਕੱਲ੍ਹ ਬਿਊਟੀ ਪਾਰਲਰ ਦਾ ਜ਼ਿਆਦਾ ਕੰਮ ਕਰਦੀਆਂ ਹਨ ਸਿਲਾਈ ਕਢਾਈ ਦਾ ਕੰਮ ਕਰਦੀਆਂ ਹਨ ਅਤੇ ਹੋਰ ਵੀ ਉਹ ਬਹੁਤ ਚੰਗੇ ਕੰਮ ਕਰਦੀਆਂ ਹਨ ਜੇ ਜਿਸ ਕਰਕੇ ਔਰਤਾਂ ਅੱਜ ਦੇ ਸਮੇਂ ਵਿੱਚ ਬਹੁਤ ਅੱਗੇ ਆ ਰਹੀ ਹਨ ਅਤੇ ਉਹ ਇੱਧਰ ਉੱਧਰ ਜੇ ਕਿਤੇ ਵੀ ਕੰਮ ਕਾਰ ਲਈ ਉਹਨਾਂ ਜਾਣਾ ਹੈ ਘਰ ਤੋਂ ਦੂਰ ਅਤੇ ਉਹ ਆਪਦਾ ਆਪ ਜਾਂਦੀਆਂ ਹਨ ਅਤੇ ਆਪਣੇ ਵਹੀਕਲ ਲੈ ਕੇ ਜਾਂਦੀਆਂ ਹਨ ਗੱਡੀਆਂ ਮੋਟਰਾਂ 'ਤੇ ਜਾਂਦੀਆਂ ਹਨ ਅਤੇ ਔਰਤਾਂ ਦੀ ਬਹੁਤ ਭੂਮਿਕਾ ਖੇਤਰ ਅੱਗੇ ਵੱਧ ਚੁੱਕੀ ਹੈ ਅਤੇ ਇਸ ਲਈ ਸਾਨੂੰ ਵੀ ਬਹੁਤ ਮਾਣ ਹੈ